ਸਤਿ ਸ਼੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਸਾਡੇ ਪੰਜਾਬੀ ਵਿੱਚ ਪੰਜਾਬ ਦੇ ਜਿਹੜੇ ਸਥਾਨਕ ਪਕਵਾਨ ਹੈ ਉਨ੍ਹਾਂ ਵਿੱਚ ਛੋਲੇ ਕੁਲਚੇ ਨਾਨ ਫਿਰ ਭ ਛੋਲੇ ਭਟੂਰੇ ਆਪਾਂ ਛੋਲੇ ਭਟੂਰੇ ਆਦਿ ਵਗੈਰਾ ਹਨ ਅਤੇ ਸਾਗ ਢੋਡਾ ਅਤੇ ਪੰਜਾਬ ਦਾਲ ਮੱਖਣੀ ਦਾਲ ਮੱਖਣੀ ਢੋਡਾ ਰੁਮਾਲੀ ਫੁਲਕਾ ਆਦਿ ਆਦਿ ਚੀਜ਼ਾਂ ਹਨ ਲੋਕ ਬਹੁਤ ਐਨ ਖੁਸ਼ ਹੋ ਕੇ ਅਤੇ ਮਸ਼ਹੂਰ ਵਾਲੇ ਕੋਲੋਂ ਖਾਂਦੇ ਹਨ ਵਧੀਆ ਵੀ ਰੈਸਟੋਰੈਂਟ ਜਿੱਦਾਂ ਕਾਂਤ ਰੈਸਟੋ ਕਾਂਤ ਰੈਸਟੋਰੈਂਟ ਫਿਰ ਹਵੇਲੀ ਸਾਂਝੀ ਸਾਡਾ ਚੁੱਲ੍ਹਾ ਸਾਂਝੀ ਸਾਂਝ ਸਾਂਝਾ ਚੁੱਲ੍ਹਾ ਸਾਡੀ ਹਵੇ ਹਵੇਲੀ ਇਹ ਵਧੀਆ ਵਧੀਆ ਰੈਸਟੋਰੈਂਟ ਹਨ ਢਾਬੇ ਆਪਣਾ ਢਾਬਾ ਫਿਰ ਆਪਣਾ ਢਾਬਾ ਪੰਜਾਬੀ ਢਾਬਾ ਫਿਰ ਬੰਬਲਾ ਢਾਬਾ ਆਦਿ ਇਹੋ ਜਿਹੇ ਢਾਬੇ ਵਧੀਆ ਲੋਕ ਜਿਹੜੇ ਜਿਹੜੇ ਕਿ ਵਾਹਵਾ ਫੇਮਸ ਜਿਹੜੇ ਕਿ ਪੰ ਮਸ਼ਹੂਰ ਢਾਬੇ ਹਨ ਸਾਡੇ ਖੇਤਰ ਦੇ ਅਤੇ ਇਹਨਾਂ ਉੱਤੇ ਕਾਫ਼ੀ ਤਰੀਕੇ ਦੇ ਵੱਖ ਵੱਖ ਤਰ੍ਹਾਂ ਦੇ ਦਾਲਾਂ ਫੇਰ ਸਬਜ਼ੀਆਂ ਨਾਨ ਕੁਲਚੇ ਛੋਲੇ ਭਟੂਰੇ ਆਦਿ ਇਹ ਚੀਜ਼ਾਂ ਮਿਲਦੀਆਂ ਹਨ ਅਤੇ ਇਹਨਾਂ ਦੀ ਵੱਖ ਵੱਖ ਅਤੇ ਇਹਨਾਂ ਦੀ ਟਾਈਮਿੰਗ ਹੈ ਜਿਹੜੇ ਕਿ ਛੋਲੇ ਭਟੂਰੇ ਕੁਲਚੇ ਵਗੈਰਾ ਇਹ ਸਾਨੂੰ ਮਤਲਬ ਕਿ ਸਵੇਰ ਦੇ ਟੈਮ ਮਿਲਦੇ ਹਨ ਜਿਹੜੇ ਢਾਬੇ ਹੈ ਉਹਨਾਂ 'ਤੇ ਜ਼ਿਆਦਾ ਲੋਕ ਰਾਤ ਨੂੰ ਖਾਣਾ ਢਾਬੇ 'ਤੇ ਖਾਣਾ ਪਸੰਦ ਕਰਦੇ ਹਨ ਅਤੇ ਰੈਸਟੋਰੈਂਟਾਂ ਵਿੱਚ ਲੋਕ ਰਾਤ ਨੂੰ ਜ਼ਿਆਦਾ ਖਾਣਾ ਖਾਣਾ ਪਸੰਦ ਕਰਦੇ ਹਨ ਅਤੇ ਜਿਹੜੇ ਹੈਗੇ ਹਨ ਛੋਲੇ ਭਟੂਰੇ ਵਗੈਰਾ ਇਹਨਾਂ ਦਾ ਕੰਮ ਜਿਹੜਾ ਉਹ ਜ਼ਿਆਦਾਤਰ ਸਵੇਰ ਦੇ ਸਮੇਂ ਜ਼ਿਆਦਾ ਹੁੰਦਾ ਹੁੰਦਾ ਵਾ ਅਤੇ ਲੋਕ ਜਿਹੜੇ ਹੈ ਸਾਗ ਢੋਡਾ ਫਿਰ ਸਾਗ ਦਾਲ ਮੱਖਣੀ ਇਹ ਲੋਕ ਜ਼ਿਆਦਾ ਪਸੰਦ ਕਰਦੇ ਹਨ ਖਾਣਾ